ਹੈਲੋ ਹਾਂਜੀ ਹਾਂਜੀ ਮੈਂ ਪੁੱਛਣਾ ਚਾਹ ਰਹੀ ਸੀ ਤੁਸੀਂ ਫਾਜ਼ਿਲਕਾ ਫਾਜ਼ਿਲਕਾ 'ਚ ਹੀ ਹੋ ਨਾ ਫਾਜ਼ਿਲਕਾ ਲੋਕਲ ਹੀ ਤੁਸੀਂ ਹਾਂਜੀ ਕਿਵੇਂ ਫਾਜ਼ਿਲਕਾ ਸਿਟੀ ਕਿਵੇਂ ਹੈ ਵਧੀਆ ਅੱਛਾ ਜੀ ਕਿਵੇਂ ਕਿਸ ਤਰ੍ਹਾਂ ਸੁਧਾਰ ਮੰਨਦੇ ਹੋ ਤੁਸੀਂ ਸੁਧਾਰ ਨੂੰ ਅੱਛਾ ਜੀ ਅੱਛਾ ਪਰ ਅੱਛਾ ਤਾਂ ਬਣ ਗਿਆ ਬਸ ਸਟੈਡ ਮੈਂ ਵਿਜ਼ਿਟ ਕੀਤਾ ਇੱਕ ਦੋ ਵਾਰੀ ਕੋਈ ਸਫਾਈ ਵਗੈਰਾ ਦਾ ਨਹੀਂ ਹੈਗਾ ਚਾਹੁੰਦਾ ਕੋਈ ਨਵੀਆਂ ਚਲਾਈਆਂ ਪਰ ਜਿਹੜੀ ਪਬਲਿਕ ਹੈ ਜਦੋਂ ਤੱਕ ਪਬਲਿਕ ਕੋਪਰੇਟ ਨਹੀਂ ਕਰਦੀ ਮੇਰੇ ਹਿਸਾਬ ਨਾਲ ਮੈਂ ਦੇਖਿਆ ਹੈ ਕਈ ਵਾਰੀ ਜਿੰਨਾ ਮਰਜ਼ੀ ਗੌਰਮੈਂਟ ਕਰ ਦਵੇ ਪਬਲਿਕ ਜਿੰਨੀ ਦੇਰ ਤੱਕ ਕੋਪਰੇਟ ਨਹੀਂ ਕਰਦੀ ਉਹ ਸਰਕਾਰ ਦੀ ਸਾਰੀ ਕੋਸ਼ਿਸ਼ ਜਿਹੜੀ ਹੈ ਉਹ ਕਾਮਯਾਬ ਨਹੀਂ ਹੁੰਦੀ ਸੁਧਾਰ ਦਾ ਵੀ ਜਿਹੜਾ ਪ੍ਰੋਜੈਕਟ ਸਰਕਾਰ ਚਲਾਉਣਾ ਚਾਹੁੰਦੀ ਉਹ ਕਾਮਯਾਬ ਨਹੀਂ ਹੋ ਪਾਉਂਦਾ ਲੋਕਾਂ ਦੀ ਕੋਪਰੇਸ਼ਨ ਘੱਟ ਕਰਕੇ ਮੇਰੇ ਅਕੋਰਡਿੰਗ ਮੈਂ ਦੇਖਿਆ ਫਾਜ਼ਿਲਕਾ ਸਿਟੀ 'ਚ ਵੀ ਮਤਲਬ ਕਿ ਲੋਕ ਜਿਵੇਂ ਸਫਾਈ ਖਾਧੇ ਚਿਪਸ ਖਾਧੇ ਰੈਪਰ ਉਵੇਂ ਹੀ ਸੁੱਟ ਦਿੱਤੇ ਹੈ ਨਾ ਅਤੇ ਹਾਲਾਂਕਿ ਡਸਟਬੀਨ ਬੜੇ ਵੱਡੇ ਵੱਡੇ ਲੱਗੇ ਹੋਏ ਨੇ ਬਸ ਸਟੈਂਡਾਂ 'ਤੇ ਬਸ ਸਟੈਂਡਾਂ 'ਤੇ ਕਾਫੀ ਵੱਡੇ ਲੱਗੇ ਨੇ ਵੀ ਲੋਕਾਂ ਦੀ ਕੋਸ਼ਿਸ਼ ਮੈਨੂੰ ਨਜ਼ਰ ਨਹੀਂ ਆਉਂਦੀ ਮੈਂ ਇਹ ਕਮੀ ਦੇਖੀ ਹੈ ਮੂੰਗਫਲੀ ਖਾਧੀ ਕਚਰਾ ਬਿਲਕੁਲ ਐਨ ਕਿੰਨੀ ਦੇਰ ਮੇਰੀ ਨਜ਼ਰ ਐਵੇਂ ਹੀ ਰਹੀ ਵੀ ਦੇਖਦੀ ਕੀ ਓਬਜਰਵੇਸ਼ਨ ਆਪਾਂ ਕਹਿੰਦੇ ਆ ਜਨਰਲ ਓਬਸਰਵ ਕੀਤਾ ਮਤਲਬ ਕਿ ਬੜਾ ਪਬਲਿਕ ਮੈਨੂੰ ਥੋੜ੍ਹਾ ਦੁੱਖ ਵੀ ਹੋਇਆ ਵੀ ਸਰਕਾਰ ਦੇਖੋ ਕਿੰਨਾ ਕੁਛ ਪਿਆ ਇੱਧਰ ਡਸਟਵੀਨ ਹੈ ਇੱਧਰ ਡਸਟਵੀਨ ਹੈ ਸਾਹਮਣੇ ਡਸਟਵੀਨ ਹੈ ਥੋੜ੍ਹਾ ਜਿਹਾ ਚਾਰ ਕਦਮ ਚੱਲ ਕੇ ਵਿੱਚ ਸੁੱਟਣ ਦੀ ਬਜਾਏ ਐਵੇਂ ਲੋਕ ਸੁੱਟ ਰਹੇ ਨੇ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਕੋਈ ਪ੍ਰੋਜੈਕਟ ਲੈ ਕੇ ਆਉਣਾ ਚਾਹੀਦਾ ਸੀਟੀ ਨੂੰ ਹੈ ਨਾ ਲੋਕਲ ਜਿਹੜੇ ਲੋਕਲ ਨੁਮਾਇੰਦੇ ਨੇ ਲੋ ਲੋਕਲ ਜਿਹੜੇ ਸਮਾਜ ਦੇ ਵਿੱਚ ਸੰਸਥਾਵਾਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਨਾ ਇਸ ਚੀਜ਼ ਬਾਰੇ ਹੋਰ ਸੁਧਾਰ ਕਿਆ ਹਾਂ ਬਿਲਕੁਲ ਬਿਲਕੁਲ ਬਿਲਕੁਲ ਇਹ ਸੰਸਕਾਰ ਇਹ ਬਹੁਤ ਵੱਡੀ ਚੀਜ਼ ਨੇ ਫਿਰ ਵੀ ਕਮੀ ਮਤਲਬ ਕਿ ਹੈ ਹੋਰ ਸੁਧਾਰ ਰੇਲਵੇ ਸਟੇਸ਼ਨ ਦਾ ਨਵਾਂ ਬਣ ਰਿਹਾ ਰੇਲਵੇ ਸਟੇਸ਼ਨ ਹਾਲੇ ਬਣ ਰਿਹਾ ਕਿ ਪੂਰਾ ਹੋ ਚੁੱਕਿਆ ਹੋਰ ਕੀ ਨਵਾਂ ਬਣਿਆ ਇੱਥੇ ਫਾਜ਼ਿਲਕਾ 'ਚ ਫਲਾਈ ਓਵਰ ਕਾਫੀ ਬਣ ਜਾਏ ਹੈ ਨਾ ਹੋਰ ਨਵੇਂ ਰੋਡਸ ਵਗੈਰਾ ਸੜਕਾਂ ਵਗੈਰਾ ਸਿਵਲ ਹੋਸਪੀਟਲ ਅੱਛਾ ਜੀ ਠੀਕ ਹੈ ਪਹਿਲਾਂ ਨਾਲੋਂ ਤਾਂ ਹੁਣ ਦੇ ਟਾਈਮ 'ਚ ਕਾਫੀ ਡਿਫਰੈਂਸ ਹੈ ਕਾਫੀ ਪ੍ਰੋਗਰੈਸ ਕਰ ਰਹੀ ਸਿਟੀ ਹੈ ਨਾ ਹਾਂ ਇਹ ਤਾਂ ਦੇਖਣ 'ਚ ਆਇਆ ਬਸ ਥੋੜ੍ਹੀ ਜਿਹੀ ਲੋਕਾਂ ਦੀ ਕਓਪਰੇਸ਼ਨ ਮਿਲੇ ਪੂਰਾ ਐਂ ਕਲੀਨ ਸਿਟੀ ਗ੍ਰੀਨ ਸਿਟੀ ਕਲੀਨ ਸਿਟੀ ਹੈ ਨਾ ਨਜ਼ਰ ਆਇਆ ਹੋਰ ਹੋਰ ਕੋਈ ਨਵੀਂ ਚੀਜ਼ ਫਾਜ਼ਿਲਕਾ ਦੀ ਦੱਸੋ ਜਿਹੜੀ ਤੁਹਾਨੂੰ ਬਹੁਤ ਅੱਛੀ ਲੱਗਦੀ ਹੋਏ ਕੋਈ ਨਵੀਂ ਚੀਜ਼ ਐਕਸਟਰਾ ਓਡਰਨਰੀ ਬਾਕੀ ਸਿਟੀ ਨਾਲੋਂ ਅਲੱਗ ਚੀਜ਼ ਕੋਈ ਦੇਖਣ ਵਾਲੀ ਲੱਗਿਆ ਹੈ ਨਾ ਠੀਕ ਹੈ ਅੱਛਾ ਜੀ ਠੀਕ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਜੇ ਇੰਨੇ ਅੱਛੇ ਡੋਕਟਰ ਨੇ ਹਾਈਲੀ ਕੁਆਲੀਫਾਈਡ ਹੁੰਦੇ ਨੇ ਗੌਰਮੈਂਟ ਹੋਸਪੀਟਲਸ ਵਿੱਚ ਹੈ ਨਾ ਲੋਕ ਪ੍ਰਾਈਵੇਟ ਵੱਲ ਭੱਜਦੇ ਨੇ ਲੋਕਾਂ ਨੂੰ ਵੀ ਚਾਹੀਦਾ ਥੋੜ੍ਹਾ ਗੌਰਮੈਂਟ ਆਪਾਂ ਨੂੰ ਫੈਸਿਲਿਟੀਸ ਦੇ ਰਹੀ ਹੈ ਅਤੇ ਆਪਾਂ ਉਹਨਾਂ ਦਾ ਬੈਨੀਫਿਟ ਲਈਏ ਹਾਂਜੀ ਹਾਂਜੀ ਹਾਂਜੀ

ਬਾਕੀ ਡੋਕਟਰ ਤਾਂ ਅੱਛੇ ਹੈ ਡੋਕਟਰ ਡਿਊਟੀਜ਼ ਵੀ ਆਪਣੇ ਮਿਲਦੇ ਹੈ ਕਿ ਨਹੀਂ ਮਿਲਦੇ ਡਿਊਟੀਜ਼ ਡਿਊਟੀਜ਼ 'ਤੇ ਵੀ ਮਿਲਦੇ ਹੈ ਡੋਕਟਰ ਕਿ ਨਹੀਂ ਮਿਲਦੇ ਡੋਕ ਹੋਸਪੀਟਲ ਅੱਛਾ ਬਣਿਆ ਡੋਕਟਰਸ ਹਾਂ ਬਹੁਤ ਅੱਛੇ ਸਿਆਣੇ ਹੈ ਡਿਊਟੀਜ਼ 'ਤੇ ਹੀ ਨਹੀਂ ਕਈ ਵਾਰੀ ਮਿਲਦੇ ਇਹ ਵੀ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਡਿਊਟੀਜ਼ 'ਤੇ ਮਿਲਦੇ ਹੈ ਡੋਕਟਰ ਕਿ ਨਹੀਂ ਮਿਲਦੇ ਇਹ ਦੱਸੋ ਆਪਾਂ ਵਿਜਿਟ ਕਰਨ ਜਾਂਦੇ ਹਾਂ ਠੀਕ ਹੈ ਇਹ ਵੀ ਸੁਧਾਰ ਹੈ ਇਹ ਵੀ ਬਹੁਤ ਵੱਡਾ ਸੁਧਾਰ ਹੈ ਜੇ ਡੋਕਟਰ ਆਪਣੀ ਸੀਟ 'ਤੇ ਬੈਠਾ ਸਰਕਾਰੀ ਹੋਸਪੀਟਲ 'ਚ ਤਾਂ ਬਹੁਤ ਵੱਡਾ ਸੁਧਾਰ ਹੈ ਇਹ ਇਹਨੂੰ ਮੈਂ ਬਹੁਤ ਵੱਡਾ ਸੁਧਾਰ ਮਿਲਿਆ ਹੈ ਇਹਨੂੰ ਆਪਾਂ ਸੁਧਾਰ ਕਿਉਂਕਿ ਆਪਾਂ ਅੱਗੇ ਵੀ ਹੋਸਪੀਟਲਾਂ 'ਚ ਜਾਂਦੇ ਸੀ ਡੋਕਟਰ ਮਿਲਦੇ ਹੀ ਨਹੀਂ ਸੀ ਆਪਣੇ ਪ੍ਰਾਈਵੇਟ ਕਲੀਨਿਕ ਇੱਧਰ ਉੱਧਰ ਵੀ ਨਾਲ ਚਲਦੇ ਰਹਿੰਦੇ ਹੈ ਨਾ ਜੇ ਡੋਕਟਰ ਗੌਰਮੈਂਟ ਹੋਸਪੀਟਲ 'ਚ ਅੱਜ ਬੈਠੇ ਹੈ ਤਾਂ ਇਹ ਨਾ ਮਤਲਬ ਹੈ ਸੁਧਾਰ ਵਾਕਈ ਹਾਂਜੀ ਚਲੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ